ਮੈਂ ਬਿਲਕੁਲ ਜੀ ਮੈਂ ਅਗਰ ਮੈਂ ਗੱਲ ਕਰਾਂ ਤਕਨੀਵੀ ਉ ਤਕਨੀਕੀ ਉੱਦਮੀ ਆਪਣਾ ਜਿਹੜਾ ਹੈਗਾ ਜਿਹੜੇ ਅੰਧਪਨਰ ਹੁੰਦੇ ਨੇ ਉਹ ਆਪਣਾ ਬਿਲਕੁਲ ਜੀਵਨ ਬਦਲ ਸਕਦੇ ਨੇ ਅਗਰ ਤੁਸੀਂ ਤੁਹਾਡੇ ਕੋਲ ਬਹੁਤ ਵਧੀਆ ਸਕਿਲਸ ਨੇ ਅਗਰ ਸਕਿੱਲਸ ਤੁਹਾਡੇ ਟੈਕਨੀਕਲ ਹੈਗੇ ਨੇ ਅਤੇ ਇੱਕ ਅੱਛਾ ਸਾ ਸਟਾਰਟ ਅਪ ਵੀ ਕਰ ਸਕਦੇ ਹਾਂ ਕਿਉਂਕੀ ਸਟਾਰਟ ਅਪ ਲਈ ਸਾਨੂੰ ਸਿਰਫ ਇੱਕ ਆਈਡੀਆ ਚਾਹੀਦਾ ਜਿੱਦਾਂ ਮੈਂ ਗੱਲ ਕਰਾਂ ਕਿ ਮੈਂ ਚਾਹੁੰਦਾ ਕੋਈ ਇੱਕ ਡਿਵਾਈਸ ਡਿਵਲਪ ਕਰਨਾ ਚਾਹੁੰਦਾ ਜੋ ਮੈਂ ਇੱਕ ਵਹੀਕਲ ਦੇ ਉੱਤੇ ਲਗਾ ਕੇ ਉਹਦਾ ਮੈਂ ਸਾਰੀ ਡਿਟੇਲਸ ਉਹਨੂੰ ਕੀ ਪਰੇਸ਼ਾਨੀ ਵਹੀਕਲ ਦਿੰਦਾ ਕਿਹੜੀ ਦਿੱਕਤ ਆ ਰਹੀ ਹੈ ਜਾ ਇੰਜਨ ਕਿਹੜੀ ਦਿੱਕਤ ਆ ਰਹੀ ਹੈ ਜਾਂ ਉਹਦੀ ਟਾਇਰਸ 'ਚ ਕਿਹੜੀ ਪਰੇਸ਼ਾਨੀ ਆ ਰਹੀ ਹੈ ਅਤੇ ਇੱਦਾਂ ਦੀ ਚੀਜ਼ ਮੈਂ ਡਿਵੈਲਪ ਕਰਦਾ ਅਤੇ ਹੋ ਸਕਦਾ ਹੈ ਕਿ ਕਾਫੀ ਚੀਜ਼ਾਂ ਦੇ ਉੱਤੇ ਅਸੀਂ ਔਰ ਕੰਮ ਕਰ ਸਕੀਏ ਅਤੇ ਇਹ ਜ਼ਰੂਰ ਇੱਕ ਬਹੁਤ ਜ਼ਰੂਰੀ ਹੈ ਸੰਸਾਰ ਲਈ ਪੂਰੀ ਦੁਨੀਆਂ ਲਈ ਜਿਹੜੀਆਂ ਚੀਜ਼ਾਂ ਅਸੀਂ ਇਹਦੇ ਉੱਤੇ ਕੰਮ ਕਰੀਏ